ਅਗਰ ਦੇਖਿਆ ਜਾਵੇ ਇੰਡੀਆ 'ਚ ਮੈਂ ਮੇਰੀ ਸਭ ਤੋਂ ਫੇਵਰੇਟ ਜਗ੍ਹਾ ਜਿੱਥੇ ਮੈਂ ਜਾਣਾ ਚਾਹੂੰਗੀ ਉਹ ਗੋਆ ਹੈ ਉੱਥੇ ਮੈਨੂੰ ਬੀਚੀਜ਼ ਬਹੁਤ ਅੱਛੀਆਂ ਲੱਗਦੀਆਂ ਉੱਥੇ ਦੀ ਜੋ ਸ਼ਾਂਤੀ ਹੈ ਇਕਾਂਤ ਮਤਲਬ ਬਹੁਤ ਪੀਸ ਹੈ ਉੱਥੇ ਔਰ ਉੱਥੇ ਦੇ ਲੋਕ ਬਹੁਤ ਇਮਾਨਦਾਰ ਅਤੇ ਮਤਲਬ ਬਹੁਤ ਅੱਛੇ ਲੋਕ ਨੇ ਉੱਥੇ ਕੋਈ ਬੇਈਮਾਨੀ ਇੱਦਾਂ ਦੀਆਂ ਚੀਜ਼ਾਂ ਨਹੀਂ ਹੈ ਅਗਰ ਤੁਸੀਂ ਆਪਣਾ ਕੋਈ ਪਰਸ ਜਾਂ ਕੁਛ ਵੀ ਕਿਤੇ ਭੁੱਲ ਕੇ ਰੱਖ ਕੇ ਆ ਗਏ ਹੋ ਨਾ ਉਹ ਚੀਜ਼ ਤੁਹਾਨੂੰ ਦੂਸਰੇ ਦਿਨ ਉੱਥੇ ਹੀ ਮਿਲੇਗੀ ਇਹ ਮੇਰੇ ਨਾਲ ਹੋ ਚੁੱਕਿਆ ਮੈਂ ਆਪਣਾ ਹੈਂਡ ਬੈਗ ਭੁੱਲ ਕੇ ਆ ਗਈ ਸੀ ਬੀਚ 'ਤੇ ਅਤੇ ਔਰ ਇੱਥੇ ਉੱਥੇ ਇੰਨਾ ਜ਼ਿਆਦਾ ਮਤਲਬ ਭੀੜ ਵਾਲਾ ਏਰੀਆ ਸੀ ਉਹ ਇਲਾਕਾ ਸੀ ਬਟ ਉਹ ਦੂਸਰੇ ਦਿਨ ਜਦੋਂ ਅਸੀਂ ਗਏ ਸੁਬਾਹ ਦੇਖਣ ਉੱਥੇ ਉਹ ਉੱਥੇ ਹੀ ਪਿਆ ਸੀ ਮਤਲਬ ਉਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਉੱਥੇ ਦੀ ਇਮਾਨਦਾਰੀ ਸਭ ਤੋਂ ਔਰ ਦੂਸਰੀ ਚੀਜ਼ ਜੋ ਹੈ ਮੈਂ ਸਭ ਤੋਂ ਮਤਲਬ ਬਾਹਰ ਦੇ ਦੇਸ਼ਾਂ 'ਚ ਮੈਨੂੰ ਨਿਊਜ਼ੀਲੈਂਡ ਬਹੁਤ ਅੱਛਾ ਲੱਗਦਾ ਉੱਥੇ ਮੇਰੇ ਕਜ਼ਨਸ ਵੀ ਰਹਿੰਦੇ ਹੈ ਮਤਲਬ ਜਿੱਦਾਂ ਉਹ ਦੱਸਦੇ ਹੈ ਉੱਥੇ ਦੀ ਉੱਥੇ ਵੀ ਇਹ ਚੀਜ਼ਾਂ ਇਮਾਨਦਾਰੀ ਬਹੁਤ ਹੈ ਇਨਸਾਨ ਦੀ ਕਦਰ ਜੋ ਹੈ ਵੈਲਯੂ ਬਹੁਤ ਜ਼ਿਆਦਾ ਹੈ ਉੱਥੇ ਨਾ ਔਰ ਉਹਨਾਂ ਦੇਸ਼ਾਂ 'ਚ ਵੀ ਇਮਾਨਦਾਰੀ ਹੈ ਇਮਾਨਦਾਰੀ ਤੋਂ ਇਲਾਵਾ ਉੱਥੇ ਦਾ ਵੈਦਰ ਬਹੁਤ ਅੱਛਾ ਹੈ ਮਤਲਬ ਅਸੀਂ ਦੋਨੋਂ ਉਹਨਾਂ 'ਚ ਕੰਮ ਕਰ ਸਕਦੇ ਨਾ ਜ਼ਿਆਦਾ ਠੰਢ ਹੈ ਉੱਥੇ ਅਤੇ ਨਾ ਹੀ ਜ਼ਿਆਦਾ ਉੱਥੇ ਗਰਮੀ ਹੈ ਔਰ ਮੌਸਮ ਇੰਨਾ ਅੱਛਾ ਹੈ ਇੱਦਾਂ ਮਤਲਬ ਜੋ ਅਸੀਂ ਤਸਵੀਰਾਂ 'ਚ ਦੇਖਦੇ ਹਾਂ ਨਾ ਕਿ ਮਤਲਬ ਜੰਨਤ ਉਦਾਂ ਦਾ ਹੀ ਬਿਲਕੁਲ ਉਹਨਾਂ ਦਾ ਜੋ ਵਿਊ ਜੋ ਹੈ ਬਹੁਤ ਵਧੀਆ ਹੈ ਉੱਥੇ ਔਰ ਬੱਚਿਆਂ ਲਈ ਬਹੁਤ ਅੱਛਾ ਹੈ ਉੱਥੇ ਮੈਡੀਕਲ ਫੈਸਿਲਿਟੀਜ਼ ਬਹੁਤ ਅੱਛੀਆਂ ਇਵਨ ਕਿ ਆਪਾਂ ਉੱਥੇ ਸੈੱਟ ਵੀ ਹੋ ਸਕਦੇ ਹਾਂ ਮਤਲਬ ਬਹੁਤ ਅੱਛਾ ਹੈ ਨਿਊਜ਼ੀਲੈਂਡ ਔਰ ਗੋਆ ਮੇਰੀ ਨਜ਼ਰ 'ਚ ਮੈਂ ਅਗਰ ਲਾਈਫ 'ਚ ਜਾਣਾ ਚਾਹੂੰਗੀ ਗਈ ਵੀ ਹਾਂ ਬਸ ਇਹੀ ਹੈ ਜੀ